ਮੈਨੂੰ ਭੰਗੜਾ ਬਹੁਤ ਪਸੰਦ ਹੈ ਜੋ ਕਿ ਮੈਂ ਕਰਨਾ ਔਰ ਦੇਖਣਾ ਬਹੁਤ ਪਸੰਦ ਕਰਦੀ ਹਾਂ ਇਹਨਾਂ ਦੇ ਵਿੱਚ ਮੈਨੂੰ ਸਭ ਤੋਂ ਵੱਧ ਇਹ ਪਸੰਦ ਹੁੰਦਾ ਹੈ ਕਿ ਇਹ ਪੱਟਾਂ ਦੇ ਜ਼ੋਰ ਨਾਲ ਕੀਤਾ ਜਾਂਦਾ ਹੈ ਆ ਔਰ ਬਹੁਤ ਸਾਰੀਆਂ ਇੱਦਾਂ ਦੀਆਂ ਇਹਨਾਂ ਦੇ ਵਿੱਚ ਜਿਹੜੀਆਂ ਲੋਕ ਬੋਲੀਆਂ ਹੁੰਦੀਆਂ ਹਨ ਜੋ ਕਿ ਸਾਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਮੇਰੇ ਕੋਲ ਸਮਾਂ ਘੱਟ ਹੋਣ ਕਰਕੇ ਅ ਮੈਂ ਕਰ ਨਹੀਂ ਪਾਉਂਦੀ ਬਟ ਜਦੋਂ ਵੀ ਮੇਰੇ ਕੋਲ ਮੌਕਾ ਮਿਲਦਾ ਹੈ ਤਾਂ ਮੈਂ ਆਪਣੀਆਂ ਅ ਟੈਂਸ਼ਨ ਫਰੀ ਹੋਣ ਲਈ ਇਹਨੂੰ ਕਰਨਾ ਪਸੰਦ ਕਰਦੀ ਹਾਂ